ਜਿਵੇਂ ਸਾਨੂੰ ਪਤਾ ਹੀ ਹੈ ਕਿ ਗਾਉਣ ਦੇ ਵਿੱਚ ਸਾਹ ਨੂੰ ਨਿਯੰਤਰਣ ਰੱਖਣਾ ਤਾਂ ਬਹੁਤ ਜ਼ਰੂਰੀ ਹੈ ਜੇਕਰ ਅਸੀਂ ਸਾਹ 'ਤੇ ਨਿਯੰਤਰਣ ਹੀ ਨਾ ਰੱਖ ਪਾਏ ਤਾਂ ਸਾਡਾ ਗਾਉਣਾ ਵਿਅਰਥ ਆ ਕਿਉਂਕਿ ਅਸੀਂ ਜਦੋਂ ਵੀ ਕੋਈ ਚੀਜ਼ ਗਾਉਂਦੇ ਹਾਂ ਤਾਂ ਉਸਨੂੰ ਉੱਚੇ ਸੁਰ 'ਚ ਜਾਂਦੇ ਹਾਂ ਜਾਂ ਉਸਨੂੰ ਉਪਰੋਂ ਥੱਲੇ ਨੂੰ ਲੈ ਕੇ ਆਉਂਦੇ ਹਾਂ ਸੁਰ ਵਿੱਚ ਹੀ ਆਉਂਦੇ ਹਾਂ ਅਤੇ ਇਸ ਤਰ੍ਹਾਂ ਹੀ ਜੇ ਸਾਡਾ ਸਾਹ ਨਿਯੰਤਰਣ ਨਾ ਹੋਵੇਗਾ ਤਾਂ ਨਾ ਹੀ ਅਸੀਂ ਆਸਾਨੀ ਨਾਲ ਉੱਪਰ ਜਾ ਸਕਦੇ ਹਾਂ ਅਤੇ ਨਾ ਹੀ ਆਸਾਨੀ ਨਾਲ ਹੇਠਾਂ ਆ ਸਕਦੇ ਹਾਂ ਇਸ ਵਿੱਚ ਸਾਨੂੰ ਸਹਾਇਤਾ ਦੇ ਦੋ ਪਾਰਟ ਮਿਲਦੇ ਹਨ ਜਿਵੇਂ ਅਸੀਂ ਸਾਹ ਨੂੰ ਕੰਟਰੋਲ ਕਰਨਾ ਅਤੇ ਨਾਲ ਅਸੀਂ ਹਰਮੋਨੀਅਮ ਦੀ ਵਰਤੋਂ ਵੀ ਕਰ ਸਕਦੇ ਹਾਂ ਹਰਮੋਨੀਅਮ 'ਤੇ ਸੱਤ ਸਵਰ ਲਿਖੇ ਹੁੰਦੇ ਆ ਸਾ ਰੇ ਗਾ ਮਾ ਪਾ ਧਾ ਨੀ ਸਾ ਤੋ ਸਾ ਸਾ ਨੂੰ ਆਪਾਂ ਨੱਪ ਕੇ ਅਤੇ ਉਸ ਦੇ ਨਾਲ ਅਸੀਂ ਸਾ ਲਗਾ ਕੇ ਉਸਨੂੰ ਸਾਹ ਨੂੰ ਨਿਰੰਤਰਿਤ ਰੱਖਣ ਵਿੱਚ ਮਦਦ ਲੈ ਸਕਦੇ ਹਾਂ ਅਤੇ ਜਦੋਂ ਵੀ ਅਸੀਂ ਸਾਹ ਦੀ ਪ੍ਰੈਕਟਿਸ ਕਰਨੀ ਹੈ ਤਾਂ ਸਵੇਰ ਦੇ ਚਾਰ ਵਜੇ ਤੋਂ ਇਹ ਸੱਤ ਵਜੇ ਤੱਕ ਕਰ ਸਕਦੇ ਹਾਂ ਮੈਂ ਰੋਜ਼ਾਨਾ ਸਵੇਰੇ ਦੇ ਚਾਰ ਵਜੇ ਤੋਂ ਸੱਤ ਵਜੇ ਤੱਕ ਅਭਿਆਸ ਕਰਦਾ ਹਾਂ ਸਾਨੂੰ ਇਹ ਇਸ ਦਾ ਅਭਿਆਸ ਕਰਨ ਵਿੱਚ ਕੋਈ ਵੀ ਗਰਮ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਡੀ ਚੀਜ਼ ਨਹੀਂ ਖਾਣੀ ਚਾਹੀਦੀ ਕਿਉਂਕਿ ਜ਼ਿਆਦਾ ਗਰਮ ਖਾਣ ਨਾਲ ਵੀ ਸਾਡਾ ਗਲਾ ਖ਼ਰਾਬ ਹੁੰਦਾ ਵਾ ਜਿਹਦੇ ਕਰਕੇ ਸਾਨੂੰ ਗਾਉਣ ਵਿੱਚ ਦਿੱਕਤ ਆਉਂਦੀ ਹੈ ਅਸੀਂ ਘਰ ਮਤਲਬ ਬਿਮਾਰ ਹੋ ਜਾਂਦੇ ਹਾਂ ਅਤੇ ਆਪਣਾ ਅਭਿਆਸ ਵਿੱਚ ਹੀ ਛੱਡ ਦਿੰਦੇ ਹਾਂ ਜਿਸ ਕਰਕੇ ਸਾਨੂੰ ਸਾਹ 'ਤੇ ਪਕੜ ਨਹੀਂ ਬਣਾ ਸਕਦੇ ਇਸ ਲਈ ਸਾਨੂੰ ਮਤਲਬ ਵਧੀਆ ਰਿਸ਼ਟ ਪੁਸ਼ਟ ਖਾਣਾ ਚਾਹੀਦਾ ਹੈ ਅਤੇ ਕੋਈ ਵੀ ਗਰਮ ਚੀਜ਼ ਜਾਂ ਠੰਡੀ ਚੀਜ਼ ਜਿਆਦਾ ਗਰਮ ਜਾਂ ਜਿਆਦਾ ਠੰਡੀ ਚੀਜ਼ ਨਹੀਂ ਖਾਣੀ ਚਾਹੀਦੀ ਗੀ ਨੋਰਮਲ ਚੀਜ਼ਾਂ ਖਾਣੀਆਂ ਚਾਹੀਦੀਆਂ ਵਾ ਜ਼ਿਆਦਾ ਗਰਮ ਪਾਣੀ ਨਹੀਂ ਪੀਣਾ ਚਾਹੀਦਾ ਤਾਂ ਜੋ ਅਸੀਂ ਆਪਣਾ ਨਿਰੰਤਰ ਅਭਿਆਸ ਕਰਦੇ ਰਹੀਏ ਤਾਂ ਸਾਨੂੰ ਅਭਿਆਸ ਕਰਨ ਵਿੱਚ ਕੋਈ ਦਿੱਕਤ ਨਾ ਆਵੇ ਇਸ ਤਰ੍ਹਾਂ ਹੀ ਅਸੀਂ ਜੇ ਨਿਰੰਤਰ ਅਭਿਆਸ ਕਰਾਂਗੇ ਤਾਂ ਅਸੀਂ ਆਪਣੇ ਸਾਹ 'ਤੇ ਪਕੜ ਬਣਾ ਕੇ ਰੱਖ ਸ ਪਾਵਾਂਗੇ ਸਾਨੂੰ ਇਸ ਸਾਹ ਗਾਉਣ ਦਾ ਜਿਵੇਂ ਕਿ ਮੈਂ ਹੁਣ ਉੱਚੇ ਸੁਰ ਵਿੱਚ ਗਾਉਂਦਾ ਹਾਂ ਅਤੇ ਮੇਰੀ ਸਾਹ 'ਤੇ ਪਕੜ ਥੋੜ੍ਹੀ ਬਣੀ ਹੈ ਪਰ ਹਜੇ ਪੂਰੀ ਨਹੀਂ ਬਣੀ ਕਿਉਂਕਿ ਮੈਂ ਨਿਰੰਤਰ ਅਭਿਆਸ ਕਰਦਾ ਹਾਂ ਅਤੇ ਥੋੜ੍ਹੀ ਬਹੁਤੀ ਪਕੜ ਬਣ ਗਈ ਹੈ ਜੇ ਮੈਂ ਰੋਜ਼ ਅਭਿਆਸ ਕਰਾਂਗਾ ਤਾਂ ਮੇਰੀ ਪਕੜ ਹੋਰ ਵੀ ਵੱਧ ਬਣ ਜੇਗੀ ਧੰਨਵਾਦ